ਮੈਨੂੰ ਲੱਗਦਾ ਸਾਈਕਲ ਚਲਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਸਾਈਕਲ 'ਤੇ ਬੈਲੰਸ ਕਰਨਾ ਹੈ ਉਹਦੀ ਸਪੀਡ ਉਹਦੀ ਬਰੇਕ ਅਤੇ ਰੋਡ 'ਤੇ ਆਪਾਂ ਨੇ ਕਰੋਸਿੰਗ ਦੇ ਟਾਈਮ ਬਿਲਕੁਲ ਧਿਆਨ ਨਾਲ ਕਰੋਸ ਕਰਨਾ ਹੈ ਕਿਉਂਕਿ ਮੋਸਟਲੀ ਜੋ ਐਕਸੀਡੈਂਟ ਹੁੰਦੇ ਹੈ ਉਹ ਜਦੋਂ ਅਸੀਂ ਬਿਨਾਂ ਧਿਆਨ ਸਾਈਕਲ ਚਲਾਉਂਦੇ ਹਾਂ ਉਦੋਂ ਹੀ ਹੁੰਦੇ ਆ ਅਤੇ ਜਦੋਂ ਆਪਾਂ ਮੋਸਟਲੀ ਰੋਡ ਕ੍ਰੋਸ ਕਰਦੇ ਹਾਂ ਮੇਜਰ ਰੋਡ ਤਾਂ ਉਸ ਟਾਈਮ ਪੀਰੀਅਡ 'ਚ ਹੁੰਦੇ ਹੈ ਸੋ ਮੋਸਟਲੀ ਜਦੋਂ ਵੀ ਮੈਂ ਸਾਈਕਲ 'ਤੇ ਕਿਤੇ ਵੀ ਜਾਂਦੀ ਹਾਂ ਜਾਂ ਜਦੋਂ ਪੈਦਲ ਵੀ ਕਿਤੇ ਵੀ ਜਾਂਦੀ ਹਾਂ ਤੇ ਮੈਨੂੰ ਆਪਣਾ ਆਈ ਡੀ ਪ੍ਰੂਫ ਕੁਛ ਕੈਸ਼ ਹੋ ਗਿਆ ਨਾਲ ਅਤੇ ਆਪਣੇ ਫੋਟੋਗ੍ਰਾਫ਼ਸ ਇਹ ਡਾਕੂਮੈਂਟ ਮੈਨੂੰ ਕੈਰੀ ਕਰਨਾ ਠੀਕ ਲੱਗਦੇ ਕਿਉਂਕਿ ਇਨ ਕੇਸ ਅਗਰ ਕੁਛ ਵੀ ਮਿਸਹੈਪਨਿੰਗ ਹੁੰਦੀ ਹੈ ਤਾਂ ਐਟਲੀਸਟ ਕੋਈ ਨਾ ਕੋਈ ਮੇਰੀ ਫੈਮਿਲੀ ਨੂੰ ਜ਼ਰੂਰ ਇਨਫੋਰਮ ਕਰ ਸਕੇ